ਹਾਂਜੀ ਸਭ ਤੋਂ ਚੁਣੌਤੀਪੂਰਨ ਤੈਰਾਕੀ ਕਸਰਤ ਖੜ੍ਹੇ ਪਾਣੀ ਦੇ ਵਿੱਚ ਤੈਰਾਕੀ ਕਰਨਾ ਹੈ ਖੜ੍ਹੇ ਪਾਣੀ ਦੇ ਵਿੱਚ ਤੈਰਾਕੀ ਕਰਨ ਲਈ ਪਹਿਲਾਂ ਪੂਰੀ ਕਿੱਟ ਹੋਵੇ ਅਤੇ ਫਿਰ ਹੀ ਤੈਰਾਕੀ ਹੁੰਦੀ ਹੈ ਅਤੇ ਇਸਦੇ ਵਿੱਚ ਕੁਝ ਚੁਣੌਤੀਆਂ ਹਨ ਜਿਵੇਂ ਕਿ ਖੜ੍ਹੇ ਪਾਣੀ ਦੇ ਵਿੱਚ ਘੱਟੋ ਘੱਟ ਅਸੀਂ ਪੰਜ ਮਿੰਟ ਤੱਕ ਤੈਰਾਕੀ ਕਰ ਸਕਦੇ ਹਾਂ ਜਾਂ ਕਿ ਜਿਹੜਾ ਖੜ੍ਹਾ ਪਾਣੀ ਹੁੰਦਾ ਉਸਦੇ ਵਿੱਚ ਜ਼ੋਰ ਜ਼ਿਆਦਾ ਬਾਹਾਂ ਦਾ ਲੱਗਦਾ ਅਤੇ ਲੱਤਾਂ ਦਾ ਬਵਲਿੰਗ ਕਰਨ ਸਮੇਂ ਵੀ ਜ਼ਿਆਦਾ ਜ਼ੋਰ ਲੱਗਦਾ ਹੈ ਅਤੇ ਜਿਸ ਨਾਲ ਤੈਰਾਕੀ ਕਰਨ ਵਾਲੇ ਨੂੰ ਥੋੜ੍ਹੀ ਔਕੜਾਂ ਪੇਸ਼ ਆਉਂਦੀਆਂ ਹਨ ਅਤੇ ਜਿਵੇਂ ਕਿ ਤੈਰਾਕੀ ਚੱਲਦੇ ਪਾਣੀ ਦੇ ਵਿੱਚ ਥੋੜ੍ਹੀ ਤੇਜ਼ ਗਤੀ ਦੇ ਨਾਲ ਹੋ ਜਾਂਦੀ ਹੈ ਅਤੇ ਉਵੇਂ ਹੀ ਖੜ੍ਹੇ ਪਾਣੀ ਦੇ ਵਿੱਚ ਤੈਰਾਕੀ ਕਰਨਾ ਬਹੁਤ ਜ਼ਿਆਦਾ ਔਖਾ ਕੰਮ ਹੁੰਦਾ ਹੈ ਵੱਧ ਤੋਂ ਵੱਧ ਹਰ ਤੈਰਾਕ ਦਾ ਆਪਣਾ ਸਟੈਮੀਨਾ ਹੁੰਦਾ ਹੈ ਅਤੇ ਉਹ ਕਿਸ ਤਰ੍ਹਾਂ ਪਾਣੀ ਦੇ ਵਿੱਚ ਤੈਰਦਾ ਹੈ ਉਸ 'ਤੇ ਡਿਪੈਂਡ ਕਰਦਾ ਹੈ ਉਹ ਟਾਈਮ ਲਿਮਿਟ ਵੱਧ ਤੋਂ ਵੱਧ ਦਸ ਮਿੰਟ ਪੰਦਰਾਂ ਮਿੰਟ ਇਸ ਟਾਈਮ ਹੁੰਦਾ ਹੈ ਸ ਮੇਰਾ ਟਾਈਮ ਘੱਟੋ ਘੱਟ ਪੰਜ ਮਿੰਟ ਤੈਰਾਕੀ ਮੈਂ ਕਰ ਸਕਦਾ ਹਾਂ ਅਤੇ ਵਧੀਆ ਬਵਲਿੰਗ ਕਰ ਸਕਦਾ ਹਾਂ